ਪੰਜਾਬ ਵਿੱਚ ਬੈਂਕਿੰਗ ਅਤੇ ਬੀਮਾ ਖੇਤਰ ਭਾਰਤ ਦੇ ਦੂਜੇ ਰਾਜਾਂ ਨਾਲੋਂ ਕਈ ਮਾਮਲਿਆਂ ਵਿੱਚ ਵੱਖਰਾ ਹੈ ਅਤੇ ਕਈ ਮਾਮਲਿਆਂ ਵਿੱਚ ਮਿਲਦਾ ਜੁਲਦਾ ਹੈ ਮੈਂ ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਆਪ ਜੀਆਂ ਨੂੰ ਇਸ ਬਾਰੇ ਵਿਸਥਾਰ ਪੂਰਵਕ ਦੱਸਦਾ ਹਾਂ ਪੈਂਤੀ ਸਖਾਵਾਂ ਦੀ ਉਪਲੱਬਧਤਾ ਪੰਜਾਬ ਵਿੱਚ ਵੀ ਬਾਕੀ ਰਾਜਾਂ ਵਾਂਗ ਇਹ ਬੈਂਕਾਂ ਦੀਆਂ ਸਾਖਾਵਾਂ ਵਿਆਪਕ ਤੌਰ ਤੇ ਉਪਲੱਬਧ ਹਨ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਬੈਂਕਿੰਗ ਸੰਤੁਲ ਸਹੂਲਤਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਡਿਜੀਟਲ ਬੈਂਕਿੰਗ ਪੰਜਾਬ ਵਿੱਚ ਵੀ ਡਿਜੀਟਲ ਬੈਂਕਿੰਗ ਤੇਜੀ ਨਾਲ ਵੱਧ ਰਹੀ ਹੈ ਐਥੇ ਵੀ ਮੋਬਾਈਲ ਬੈਂਕਿੰਗ ਇੰਟਰਨੈੱਟ ਬੈਂਕਿੰਗ ਅਤੇ ਹੋਰ ਡਿਜੀਟਲ ਸੇਵਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਬੀਮਾ ਉਤਪਾਦ ਪੰਜਾਬ ਵਿੱਚ ਵੀ ਬੀਮਾ ਕੰਪਨੀਆਂ ਵੱਖ ਵੱਖ ਕਿਸਮ ਦੇ ਬੀਮਾ ਉਤਪਾਦ ਪੇਸ਼ ਕਰਦੀਆਂ ਹਨ ਜਿਵੇਂ ਕੀ ਜੀਵਨ ਬੀਮਾ ਸਿਹਤ ਬੀਮਾ ਵਾਹਨ ਬੀਮਾ ਤੇ ਹੋਰ ਵੀ ਕਈ ਤਰ੍ਹਾਂ ਦੇ ਬੀਮੇ ਚੱਲਦੇ ਹਨ ਨਿਵੇਸ਼ ਪੰਜਾਬ ਦੇ ਲੋਕ ਵੀ ਬਾਕੀ ਰਾਜਾਂ ਵਾਂਗ ਹੀ ਨਿਵੇਸ਼ ਵਿੱਚ ਦਿਲਚਸਪੀ ਰੱਖਦੇ ਹਨ ਐਥੇ ਵੀ ਸ਼ੇਅਰ ਬਾਜਾਰ ਮਿਊਚੁਅਲ ਫੰਡ ਹੋਰ ਵੀ ਕਈ ਤਰ੍ਹਾਂ ਦੇ ਗਵਰਮੈਂਟ ਬੋਂਡਸ ਆਦੀ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਪੰਜਾਬ ਬਾਕੀ ਖੇਤਰਾਂ ਨਾਲੋਂ ਕਿਵੇਂ ਵੱਖ ਹੈ ਦੇਖੋ ਖੇਤੀਬਾੜੀ ਦਾ ਪ੍ਰਭਾਵ ਐ ਪੰਜਾਬ ਵਿੱਚ ਖੇਤੀ ਪ੍ਰਧਾਨ ਰਾਜ ਐ ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇਸ ਲਈ ਐਥੇ ਖੇਤੀਬਾੜੀ ਨਾਲ ਸਬੰਧਤ ਬੈਂਕਿੰਗ ਅਤੇ ਬੀਮਾ ਉਤਪਾਦਾਂ ਦੀ ਮੰਗ ਜਿਆਦਾ ਰਹਿੰਦੀ ਹੈ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਤੋਂ ਵਿਦੇਸ਼ਾਂ ਵਿੱਚ ਗਏ ਲੋਕਾਂ ਕਾਰਨ ਐਥੇ ਵਿਦੇਸ਼ੀ ਮੁਦਰਾ ਨਾਲ ਸੰਬੰਧਤ ਬੈਂਕਿੰਗ ਸੇਵਾਵਾਂ ਦੀ ਵੀ ਮੰਗ ਵੱਧ ਹੈ ਕਿਸਾਨ ਕਰਜਾ ਪੰਜਾਬ ਵਿੱਚ ਕਿਸਾਨ ਕਰਜੇ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਹੈ ਇਸ ਕਾਰਨ ਐਥੇ ਕਿਸਾਨ ਕਰਜੇ ਨਾਲ ਸੰਬੰਧਤ ਬੈਂਕਿੰਗ ਅਤੇ ਬੀਮਾ ਇੱਥੇ ਇਹਨੂੰ ਲਾਗੂ ਕਰਨ ਦੀ ਲੋੜ ਹੈ ਸਹਿਕਾਰੀ ਬੈਂਕਾਂ ਪੰਜਾਬ ਵਿੱਚ ਸਹਿਕਾਰੀ ਬੈਂਕਾਂ ਦੀ ਮਹੱਤਵਪੂਰਨ ਭੂਮਿਕਾ ਹੈ ਇਹ ਬੈਂਕ ਖੇਤੀਬਾੜੀ ਅਤੇ ਪੇਂਡੂ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਵੇਂ ਇਹਦੇ ਵਿੱਚ ਕੁਝ ਕ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਕਰਜਾ ਹੋ ਗਿਆ ਜਿਵੇਂ ਡਿਜ਼ੀਟਲ ਦਰਾਰ ਹੋ ਗਈ ਬੀਮਾ ਜਾਗਰੂਕਤਾ ਹੋ ਗਈ ਨੌਜਵਾਨਾਂ ਲਈ ਰੁਜ਼ਗਾਰ ਦੇਖੋ ਜੀ ਕਿਸਾਨ ਕਰਜਾ ਕਿਵੇਂ ਇੱਕ ਮੁੱਖ ਚੁਣੌਤੀ ਐ ਜਿਵੇਂ ਕੀ ਪਹਿਲਾਂ ਈ ਦੱਸਿਆ ਗਿਆ ਹੈ ਹਨਾ ਮੈਂ ਤੁਹਾਨੂੰ ਦੱਸਿਆ ਕਿਸਾਨ ਕਰਜਾ ਪੰਜਾਬ ਦੀ ਇੱਕ ਵੱਡੀ ਸਮੱਸਿਆ ਹੈ ਇਸ ਕਰਕੇ ਕਿਸਾਨ ਕਰਜਾ ਇੱਕ ਮੁੱਖ ਚੁਣੌਤੀ ਹੈ ਇੱਕ ਡਿਜੀਟਲ ਦਰਾਰ ਵੀ ਐ ਜੀ ਪੇਂਡੂ ਖੇਤਰਾਂ ਵਿੱਚ ਅਜੇ ਵੀ ਡਿਜੀਟਲ ਬੈਂਕਿੰਗ ਦੀ ਪਹੁੰਚ ਸੀਮਤ ਹੀ ਹੈ ਬਹੁਤ ਸਾਰੇ ਲੋਕਾਂ ਨੂੰ ਡਿਜੀਟਲ ਬੈਂਕਿੰਗ ਡਿਜੀਟਲਾਈਜੇਸ਼ਨ ਬਾਰੇ ਕੁਛ ਪਤਾ ਹੀ ਨਹੀਂ ਹੈ ਬੀਮਾ ਜਾਗਰੂਕਤਾ ਵੀ ਬਹੁਤ ਵੱਡੀ ਇੱਕ ਚੁਣੌਤੀ ਐ ਪੰਜਾਬ ਵਿੱਚ ਬੀਮਾ ਜਾਗਰੂਕਤਾ ਦੀ ਕਮੀ ਹੈ ਪੰਜਾਬ ਦੇ ਬਹੁਤ ਲੋਕਾਂ ਨੂੰ ਬੀਮੇ ਬਾਰੇ ਜਾਗਰੂਕਤਾ ਹੀ ਨਹੀਂ ਹੈ ਕੁਝ ਅਨਪੜ੍ਹ ਜਾਂ ਪਿੱਛੜੇ ਹੋਏ ਲੋਕ ਹਨ ਜਿਹੜਾ ਬੀਮੇ ਬਾਰੇ ਕੁਝ ਵੀ ਨਹੀਂ ਜਾਣਦੇ ਤੇ ਉਸ ਤੋਂ ਹੋਏ ਲਾਭ ਤੇ ਹਾਨੀ ਦਾ ਉਹਨਾਂ ਨੂੰ ਕੁਛ ਨਹੀਂ ਪਤਾ ਨੌਜਵਾਨਾਂ ਲਈ ਰੁਜ਼ਗਾਰ ਪੰਜਾਬ ਦੇ ਰੋਜ਼ਗਾਰ ਨੌ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਬੈਂਕਿੰਗ ਅਤੇ ਬੀਮਾ ਖੇਤਰਾਂ ਵਿੱਚ ਨੌਕਰੀਆਂ ਦੀ ਮੰਗ ਵੱਧ ਰਹੀ ਹੈ ਹਨਾ ਪੰਜਾਬ ਵਿੱਚ ਨੌਕਰੀਆਂ ਹੀ ਨਹੀਂ ਹਨ ਤਾਂ ਲੋਕ ਇਨਸ਼ੋਰੈਂਸ ਵੀ ਕਿੱਥੋਂ ਕਰਾਉਣਗੇ ਬੈਂਕ ਖਾਤੇ ਵੀ ਕਿੱਥੋਂ ਖੁਲਵਾਉਣਗੇ ਅੱਗੇ ਮੈਂ ਆਸ਼ਾ ਕਰਦਾ ਪੰਜਾਬ ਵਿੱਚ ਬੈਂਕਿੰਗ ਅਤੇ ਬੀਮਾ ਖੇਤਰਾਂ ਦਾ ਭਵਿੱਖ ਚਮਕਦਾਰ ਹੋਵੇਗਾ ਡਿਜੀਟਲ ਬੈਂਕਿੰਗ ਬੀਮਾ ਜਾਗਰੂਕਤਾ ਅਤੇ ਨੀਮ ਨਵੇਂ ਬੀਮਾ ਉਤਪਾਦਾਂ ਦੇ ਇਸ ਖੇਤਰ ਵਿੱਚ ਵੀ ਹੋਰ ਵਾਧਾ ਹੋਣ ਦੀ ਉਮੀਦ ਹੈਗੀ ਆ ਵੈਸੇ ਇਹ ਜਾਣਕਾਰੀ ਆਮ ਦੌਰ ਤੇ ਦਿੱਤੀ ਜਾਂਦੀ ਆ ਵਧੇਰੇ ਵਿਸਤ੍ਰਿਤ ਜਾਣਕਾਰੀ ਲਈ ਹਨਾ ਇਸ ਜਾਣਕਾਰੀ ਤੋਂ ਦੁਆਰਾ ਮੈਂ ਤੁਹਾਨੂੰ ਹੋਰ ਵੀ ਆਪਣੇ ਕੁਝ ਐਕਸਪੀਰੀਅੰਸ ਸ਼ੇਅਰ ਕਰ ਸਕਦਾ ਹਾਂ ਪਤੂ ਪ੍ਰੰਤੂ ਪਹਿਲਾਂ ਇਹ ਬੀਮਾ ਹੁਣ ਤਾਂ ਵੈਸੇ ਹੌਲੀ ਹੌਲੀ ਸਾਰੇ ਲੋਕ ਹੀ ਬੀਮੇ ਬਾਰੇ ਜਾਗਰੂਕ ਹੋ ਰਹੇ ਹਨ ਅੱਗੇ ਤੇ ਅੱਗੇ ਬੈਂਕਾਂ ਦਾ ਵੀ ਵਿਸਥਾਰ ਹੁੰਦਾ ਜਾ ਰਿਹਾ ਹੈ